ਨਹੀਂ ਮੈਂ ਅੱਜ ਤੱਕ ਕੋਈ ਵੀ ਵਰਕਸ਼ਾਪ ਜਾਂ ਕੂਕਿੰਗ ਕਲਾਸਾਂ ਵਿੱਚ ਭਾਗ ਨਹੀਂ ਲਿਆ ਮੈਂ ਸਿੱਖਣਾ ਚਾਹੁੰਦੀ ਹਾਂ ਕੇਕ ਬਣਾਉਣਾ ਮਨਚੂਰੀਅਨ ਬਣਾਉਣਾ ਜੋ ਕਿ ਮੈਨੂੰ ਬਹੁਤ ਸਵਾਦ ਲੱਗਦਾ ਹੈ ਕਚੌਰੀਆਂ ਬਣਾਉਣੀਆਂ ਬਣਾਉਣੀਆਂ ਜੋ ਕਿ ਮੈਨੂੰ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੀਆਂ ਹਨ ਪਰ ਮੈਨੂੰ ਬਣਾਉਣੀਆਂ ਨਹੀਂ ਆਉਂਦੀਆਂ ਡੌਸਾ ਬਣਾਉਣਾ ਸਾਗ ਬਣਾਉਣਾ ਇਹ ਸਭ ਕੁਛ ਮੈਂ ਵਰਕਸ਼ਾਪ ਜਾਂ ਕੂਕਿੰਗ ਕਲਾਸਾਂ ਵਿੱਚ ਸਿੱਖਣਾ ਚਾਹੁੰਦੀ ਹਾਂ